ਆਪਣੀਆਂ ਤਸਵੀਰਾਂ ਨੂੰ ਨੈਚੁਰਲ ਰੱਖਣਾ ਹੀ ਮੈਨੂੰ ਪਸੰਦ ਹੈ ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਵੀ ਘੱਟ ਤੋਂ ਘੱਟ ਜਿਹੜਾ ਸੰਪਾਦਿਤ ਕਰਾਂ ਇਹਨਾਂ ਨੂੰ ਬਾਕੀ ਅੱਜ ਕੱਲ੍ਹ ਸ ਕਿਸੇ ਸਪੈਸ਼ਲ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ ਫੋਨਾਂ ਵਿੱਚ ਹੀ ਕਾਫੀ ਸ ਚੀਜ਼ਾਂ ਜਿਹੜੀਆਂ ਆਪਸ਼ਨ ਮਿਲ ਜਾਂਦੇ ਹੈ ਜਿਨ੍ਹਾਂ ਤੋਂ ਅਸੀਂ ਉਹਨੂੰ ਸੰਪਾਦਿਤ ਕਰ ਸਕਦੇ ਹਾਂ ਜਾਂ ਉਹਨੂੰ ਹੋਰ ਵਧੀਆ ਬਣਾ ਸਕਦੇ ਹਾਂ ਅਤੇ ਜਿਹੜਾ ਸੰਪਾਦਿਤ ਕਰਨਾ ਇਸ ਇਸ ਲਈ ਕੀਤਾ ਜਾਂਦਾ ਤਾਂ ਕਿ ਤਸਵੀਰਾਂ ਨੂੰ ਹੋਰ ਜਿਹੜਾ ਖੂਬਸੂਰਤੀ ਦਿੱਤੀ ਜਾ ਸਕੇ